ਚਾਰ ਜਨਵਰੀ ਉੱਨੀ ਛਿਆਸੀ ਛੇ ਮਾਰਚ ਉੱਨੀ ਨੜ੍ਹਿਨਵੇਂ ਦਸ ਮਈ ਵੀਹ ਗਿਆਰਾਂ ਅਠਾਰਾਂ ਜੂਨ ਉੱਨੀ ਚੁਰਾਸੀ ਸਤਾਈ ਸਤੰਬਰ ਵੀਹ ਬਾਈ